ਭਾਰਤ ਵਿੱਚ ਬਹੁਤ ਜ਼ਿਆਦਾ ਖਿਡਾਰੀ ਹੋਏ ਨੇ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਭਾਰਤ ਦਾ ਨਾਮ ਭਾਰਤ ਦੇ ਨਾਮ ਨੂੰ ਰੋਸ਼ਨ ਕੀਤਾ ਏ ਆ ਉਹਨਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਏ ਆ ਮ ਮੈਨੂੰ ਇੱਕ ਨਾਮ ਯਾਦ ਆਉਂਦਾ ਹੈ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਨੇ ਉਹਨਾਂ ਦਾ ਨਾਮ ਹੈ ਮਿਲਖਾ ਸਿੰਘ ਜਿਨ੍ਹਾਂ ਨੂੰ ਉੱਡਦਾ ਹੋਇਆ ਸਿੱਖ ਵੀ ਕਿਹਾ ਜਾਂਦਾ ਏ ਆ ਯੂਥ ਉਹਨਾਂ ਨੂੰ ਬਹੁਤ ਫੋਲੋ ਕਰਦਾ ਆ ਕਿਉਂਕਿ ਉਹਨਾਂ ਦੀ ਜਿਹੜੀ ਸਟੋਰੀ ਆ ਜਦੋਂ ਮੈਂ ਜਦੋਂ ਵੀ ਮੈਂ ਕਿਸੇ ਪਰਿਸਥਿਤੀ ਦੇ ਵਿੱਚ ਹੁੰਦੀ ਹਾਂ ਤਾਂ ਮੈਂ ਉਹਨਾਂ ਦੀ ਸਟੋਰੀ ਜਦੋਂ ਵੀ ਮੈਂ ਪੜ੍ਹਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰੇਰਣਾ ਮਿਲ ਮਿਲਦੀ ਆ ਅਤੇ ਮੈਨੂੰ ਇੱਦਾਂ ਲੱਗਦਾ ਆ ਕਿ ਮੈਂ ਵੀ ਕੁਛ ਜ਼ਿੰਦਗੀ ਦੇ ਵਿੱਚ ਹਾਸਿਲ ਕਰ ਸਕਦੀ ਹਾਂ ਅਤੇ ਯੂਥ ਉਹਨਾਂ ਨੂੰ ਇਸ ਲਈ ਫੋਲੋ ਕਰਦਾ ਆ ਕਿਉਂਕਿ ਉਹਨਾਂ ਦਾ ਮੋਟਿਵ ਜਦੋਂ ਉਹ ਦੌੜਦੇ ਸੀ ਤਾਂ ਇੱਦਾਂ ਲੱਗਦਾ ਸੀਗਾ ਕਿ ਜਿਵੇਂ ਉਹ ਹਵਾ ਦੇ ਨਾਲ਼ ਗੱਲਾਂ ਕਰਦੇ ਹੋਣ ਅਤੇ ਉਸ ਤਰੀਕੇ ਨਾਲ਼ ਜੋ ਵੀ ਇਸ ਖੇਤਰ ਦੇ ਵਿੱਚ ਹ ਬੁਲੰਦੀਆਂ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ